ਭੰਗੜਾ ਇੱਕ ਅਜਿਹਾ ਨਾਚ ਹੈ ਜਿਸ ਵਿੱਚ ਸਰੀਰ ਦੀ ਹਰ ਹਰਕਤ ਖੁਸ਼ੀ ਅਤੇ ਜੋਸ਼ ਨਾਲ ਭਰੀ ਹੁੰਦੀ ਹੈ ਇਸ ਦੇ ਸਟੈਪ ਬਹੁਤ ਸਾਰੇ ਹਨ ਇਹ ਤਾਂ ਸਮੇਂ ਅਤੇ ਥਾਂ ਦੇ ਨਾਲ ਨਾਲ ਬਦਲਦੇ ਰਹਿੰਦੇ ਹਨ ਹਾਲਾਂਕਿ ਕੁਝ ਆਮ ਸਟੈਪ ਭੰਗੜੇ ਵਿੱਚ ਜਿਹੜੇ ਮੁੱਖ ਤੌਰ 'ਤੇ ਹੁੰਦੇ ਹਨ ਤਾੜੀਆਂ ਤਾੜੀਆਂ ਭੰਗੜੇ ਦਾ ਅਨਿੱਖੜਵਾਂ ਅੰਗ ਹਨ ਇਹ ਨਾ ਸਿਰਫ ਤਾਲ ਨੂੰ ਬਣਾਈ ਰੱਖਦੀਆਂ ਹਨ ਸਗੋਂ ਨੱਚਣ ਵਾਲਿਆਂ ਦੇ ਨੂੰ ਇੱਕ ਦੂਜੇ ਨਾਲ ਜੋੜਨ ਦਾ ਕੰਮ ਵੀ ਕਰਦੀਆਂ ਹਨ ਪੈਰਾਂ ਦੇ ਘੁਮਾ ਭੰਗੜੇ ਵਿੱਚ ਪੈਰਾਂ ਨੂੰ ਤੇਜ਼ੀ ਨਾਲ ਘੁਮਾਇਆ ਜਾਂਦਾ ਹੈ ਇਹ ਸਟੈਪ ਭੰਗੜੇ ਨੂੰ ਜੋਸ਼ ਨਾਲ ਭਰ ਦਿੰਦੇ ਹੈ ਹੱਥਾਂ ਦੀਆਂ ਹਰਕਤਾਂ ਭੰਗੜੇ ਵਿੱਚ ਹੱਥਾਂ ਦੀਆਂ ਬਹੁਤ ਸਾਰੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ ਇਹ ਹਰਕਤਾਂ ਨਾਚ ਨੂੰ ਹੋਰ ਵੀ ਰੰਗੀਨ ਬਣਾਉਂਦੀਆਂ ਨੇ ਸਰੀਰ ਨੂੰ ਹਿਲਾਉਣਾ ਭੰਗੜੇ ਵਿੱਚ ਸਾਰੇ ਸਰੀਰ ਨੂੰ ਹਿਲਾਇਆ ਜਾਂਦਾ ਹੈ ਇਸ ਵਿੱਚ ਕਮਰ ਨੂੰ ਹਿਲਾਉਣਾ ਮੋਢਿਆਂ ਨੂੰ ਹਿਲਾਉਣਾ ਸਿਰ ਨੂੰ ਹਿਲਾਉਣਾ ਸ਼ਾਮਿਲ ਹੈ ਭੰਗੜੇ ਦੇ ਸਟੈਪ ਅਤੇ ਪੰਜਾਬੀ ਸੱਭਿਆਚਾਰ ਭੰਗੜੇ ਦੇ ਲਈ ਇਹ ਸਟੈਪ ਪੰਜਾਬੀ ਸੱਭਿਆਚਾਰ ਵਿੱਚ ਜ਼ੋਰਦਾਰ ਅਤੇ ਜਸ਼ਨ ਵਾਲੇ ਸੁਭਾਅ ਨੂੰ ਬਹੁਤ ਵਧੀਆ ਤਰੀਕੇ ਨਾਲ ਦਰਸਾਉਂਦੇ ਹਨ ਜੋਸ਼ ਅਤੇ ਉਤਸ਼ਾਹ ਭੰਗੜੇ ਦੇ ਤੇਜ਼ ਸਟੈਪ ਅਤੇ ਤਾੜੀਆਂ ਨੱਚਣ ਵਾਲਿਆਂ ਵਿੱਚ ਜੋਸ਼ ਉਤਸ਼ਾਹ ਪੈਦਾ ਕਰਦੀਆਂ ਹਨ ਇਹ ਪੰਜਾਬੀਆਂ ਦੇ ਜੋਸ਼ੀਲੇ ਸੁਭਾਅ ਨੂੰ ਵੀ ਦਰਸਾਉਂਦਾ ਹੈ ਖੁਸ਼ੀ ਭੰਗੜੇ ਦੇ ਹਰ ਸਟੈਪ ਵਿੱਚ ਖੁਸ਼ੀ ਝਲਕਦੀ ਹੈ ਇਹ ਪੰਜਾਬੀਆਂ ਦੇ ਜੀਵਨ ਨੂੰ ਖੁਸ਼ੀ ਨਾਲ ਜੀਣ ਦੇ ਤਰੀਕੇ ਨੂੰ ਦਰਸਾਉਂਦਾ ਹੈ ਸਮੂਹਿਕਤਾ ਭੰਗੜੇ ਵਿੱਚ ਸਾਰੇ ਨੱਚਣ ਵਾਲੇ ਇੱਕ ਦੂਜੇ ਨਾਲ ਮਿਲ ਕੇ ਨੱਚਦੇ ਹਨ ਇਹ ਪੰਜਾਬੀਆਂ ਦੇ ਸਮੂਹਿਕ ਸੁਭਾਅ ਨੂੰ ਦਰਸਾਉਂਦਾ ਹੈ ਸਰਲਤਾ ਭੰਗੜੇ ਦੇ ਸਟੈਪ ਬਹੁਤ ਸਰਲ ਹੁੰਦੇ ਹਨ ਇਹ ਕਿਸੇ ਵੀ ਉਮਰ ਦੇ ਵਿਅਕਤੀ ਦੁਆਰਾ ਸਿੱਖੇ ਜਾ ਸਕਦੇ ਹਨ ਇਹ ਪੰਜਾਬੀਆਂ ਦੀ ਸਰਲਤਾ ਨੂੰ ਵੀ ਦਰਸਾਉਂਦਾ ਹੈ ਭੰਗੜਾ